ਮੈਂ ਸੋਚਦਾ ਹਾਂ ਕਿ ਅੱਜ ਕੱਲ੍ਹ ਲੋਕ ਖੇਤੀਬਾੜੀ ਤੋਂ ਦੂਰ ਹੁੰਦੇ ਜਾ ਰਹੇ ਹਨ ਅਤੇ ਖੇਤੀਬਾੜੀ ਨੂੰ ਉਲਝਣ ਵਾਲਾ ਕਿੱਤਾ ਸਮਝਦੇ ਹਨ ਕਿਉਂਕਿ ਖੇਤੀਬਾੜੀ ਇੱਕ ਮਿਹਨਤ ਵਾਲਾ ਕਿੱਤਾ ਹੈ ਅਤੇ ਫਸਲ ਪੈਦਾ ਕਰਨ ਲਈ ਅਤੇ ਉਸ ਨੂੰ ਸਾਂਭ ਸੰਭਾਲ ਲਈ ਸਮਾਂ ਅਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਅਤੇ ਜ਼ਿਆਦਾਤਰ ਲੋਕ ਆਪ ਖੇਤੀ ਕਰਨ ਦੀ ਬਜਾਏ ਜ਼ਮੀਨ ਕਿਸੇ ਦੂਸਰੇ ਨੂੰ ਠੇਕੇ 'ਤੇ ਦੇ ਦਿੰਦੇ ਹਨ ਇਸ ਤਰ੍ਹਾਂ ਕਰਨ ਨਾਲ ਆਮਦਨ ਵੀ ਘੱਟ ਜਾਂਦੀ ਹੈ ਕੁਛ ਲੋਕ ਨੌਕਰੀ ਕਰਨ ਵਾਸਤੇ ਦੂਸਰੇ ਰਾਜਾਂ ਜਾਂ ਸ਼ਹਿਰ ਆਦਿ ਚਲੇ ਜਾਂਦੇ ਹਨ ਅਤੇ ਆਪਣੀ ਖੇਤੀ ਵੱਲ ਧਿਆਨ ਨਹੀਂ ਦੇ ਪਾਉਂਦੇ ਉਹ ਵੀ ਆਪਣੀ ਜ਼ਮੀਨ ਕਿਸੇ ਦੂਸਰੇ ਨੂੰ ਦੇ ਦਿੰਦੇ ਹਨ ਮੈਂ ਸਮਝਦਾ ਹਾਂ ਕਿ ਖੇਤੀਬਾੜੀ ਇੱਕ ਲਾਹੇਵੰਦ ਧੰਦਾ ਹੈ ਅਸੀਂ ਇਸ ਤੋਂ ਚੰਗੀ ਆਮਦਨ ਲੈ ਸਕਦੇ ਹਾਂ ਆਪਣੇ ਘਰ ਖਾਣ ਵਾਸਤੇ ਸਬਜ਼ੀਆਂ ਆਦੀ ਵੀ ਬੀਜ ਸਕਦੇ ਹਾਂ ਸਬਜ਼ੀਆਂ ਆਦਿ ਵੀ ਬੀਜ ਸਕਦੇ ਹਾਂ ਕਣਕ ਚੌਲ ਆਦਿ ਰੱਖ ਸਕਦੇ ਹਾਂ ਅਸੀਂ ਆਪ ਮਿਹਨਤ ਕਰਕੇ ਦੋ ਤੋਂ ਜ਼ਿਆਦਾ ਫਸਲਾਂ ਵੀ ਲੈ ਸਕਦੇ ਹਾਂ ਇੱਕ ਸਾਲ ਦੇ ਵਿੱਚ ਅਤੇ ਚੰਗੀ ਆਮਦਨ ਕਮਾ ਸਕਦੇ ਹਾਂ